ਜ਼ਿਲ੍ਹੇ ਮੋਹਾਲੀ ਦੇ ਵਿੱਚ ਅਨੇਕਾਂ ਵਿੱਦਿਅਕ ਸੰਸਥਾਵਾਂ ਹਨ ਇਹਨਾਂ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰੇ ਜਾਂਦੇ ਹਨ ਜਿਵੇਂ ਕਿ ਸਾਇੰਸ ਪ੍ਰਯੋਗਸ਼ਾਲਾ ਕੇਂਦਰ ਆਧੁਨਿਕ ਟੈਕਨੋਲਜੀ ਲਈ ਸਕੂਲ ਕਾਲਜਾਂ ਵਿੱਚ ਕੰਪਿਊਟਰ ਅਤੇ ਪ੍ਰੋਜੈਕਟ ਆਦਿ ਦੀਆਂ ਸਹੂਲਤਾਂ ਪ੍ਰਾਪਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚੇ ਆਸਾਨੀ ਨਾਲ਼ ਸਿੱਖ ਸਕਣ ਜੇਕਰ ਅਸੀਂ ਕਿਫਾਇਤੀ ਫੀਸਾਂ ਦੀ ਗੱਲ ਕਰੀਏ ਤਾਂ ਹਰ ਸਕੂਲ ਦੀ ਆਪਣੀ ਵੱਖਰੀ ਫੀਸ ਸੂਚੀ ਹੈ ਅੱਜ ਕੱਲ੍ਹ ਬੱਚੇ ਜ਼ਿਆਦਾਤਰ ਤਕਨੀਕੀ ਵਿਸ਼ਿਆਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਕਿਉਂਕਿ ਇਹਨਾਂ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਮਿਲਦੇ ਹਨ